ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਉੱਤਰੀ ਭਾਰਤ 'ਚ ਉੱਤਰ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਉੱਤਰਾਖੰਡ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਪੰਜਾਬ ਅਤੇ ਹਰਿਆਣਾ ਆਉਂਦਾ ਹੈ ਦੱਖਣੀ ਭਾਰਤ 'ਚ ਤਮਿਲਨਾਡੂ ਆਂਧਰਾ ਪ੍ਰਦੇਸ਼ ਤੇਲੰਗਨਾ ਕਰਨਾਟਕਾ ਅਤੇ ਕੇਰਲਾ ਮੁੱਖ ਰਾਜ ਹਨ ਮੌਸਮ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ 'ਚ ਸਾਰੇ ਹੀ ਮੌਸਮ ਆਉਂਦੇ ਹਨ ਗਰਮੀ ਸਰਦੀ ਬਰਸਾਤ ਦੱਖਣੀ ਭਾਰਤ 'ਚ ਕੇਵਲ ਬਰਸਾਤ ਅਤੇ ਗਰਮੀ ਦਾ ਹੀ ਮੌਸਮ ਰਹਿੰਦਾ ਹੈ ਇੱਥੇ ਬੋਲਣ ਵਾਲੀਆਂ ਭਾਸ਼ਾਵਾਂ ਉੱਤਰੀ ਭਾਰਤ 'ਚ ਪੰਜਾਬੀ ਹਿੰਦੀ ਅਤੇ ਉਰਦੂ ਬੋਲੀ ਜਾਂਦੀ ਹੈ ਅਤੇ ਦੱਖਣੀ ਭਾਰਤ 'ਚ ਤੇਲਗੂ ਕੰਨੜ ਮਲਿਆਲਮ ਅਤੇ ਕੇਰਲਾ ਬੋਲੀ ਜਾਂਦੀ ਹੈ ਖਾਣ ਵਿੱਚ ਖਾਣ ਦੀ ਗੱਲ ਕਰੀਏ ਤਾਂ ਦੱਖਣੀ ਭਾਰਤ 'ਚ ਚੌਲ ਸਾਂਬਰ ਉਪਮਾ ਇਡਲੀ ਬੜਾ ਨਾਰੀਅਲ ਕੇਲੇ ਮੱਛੀ ਆਦਿ ਨੂੰ ਜ਼ਿਆਦਾ ਖਾਇਆ ਜਾਂਦਾ ਹੈ ਉੱਤਰੀ ਭਾਰਤ 'ਚ ਸਾਰੇ ਹੀ ਤਰ੍ਹਾਂ ਦੇ ਫੂਡ ਖਾਏ ਜਾਂਦੇ ਹਨ ਤੰਦੂਰੀ ਆਈਟਮਾਂ ਦੱਖਣੀ ਭਾਰਤ 'ਚ ਟੈਕਨੀਕਲ ਜੋਬ ਸਭ ਤੋਂ ਜ਼ਿਆਦਾ ਮਿਲਦੀਆਂ ਹਨ ਉੱਤਰੀ ਭਾਰਤ 'ਚ ਫੈਕਟਰੀਜ ਵਾਲੀਆਂ ਜੋਬਾਂ ਹਨ ਟੈਕਨੀਕਲ ਜੋਬ ਵਾਸਤੇ ਸਾਨੂੰ ਦੱਖਣੀ ਭਾਰਤ 'ਚ ਹੀ ਜਾਣਾ ਪੈਂਦਾ ਹੈ ਕੱਪੜੇ ਦੱਖਣੀ ਭਾਰਤ 'ਚ ਧੋਤੀ ਅਤੇ ਕੁੜਤਾ ਪਾਇਆ ਜਾਂਦਾ ਹੈ ਅਤੇ ਜਨਾਨੀਆਂ ਦੇ ਪਹਿਰਾਵੇ 'ਚ ਸਾੜੀ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਤਰੀ ਭਾਰਤ 'ਚ ਸਾਰੇ ਤਰ੍ਹਾਂ ਦੇ ਹੀ ਪਾਏ ਜਾਂਦੇ ਹਨ ਕੋਟ ਪੈਂਟ ਕੁੜਤੇ ਪਜਾਮੇ ਉੱਤਰੀ ਭਾਰਤ 'ਚ ਭੰਗੜਾ ਅਤੇ ਪੰਜਾਬੀ ਗਾਣੇ ਹਿੰਦੀ ਗਾਣਿਆਂ ਦਾ ਜ਼ਿਆਦਾ ਸੁਣੇ ਜਾਂਦੇ ਹਨ ਦੱਖਣੀ ਭਾਰਤ 'ਚ ਕੱਥਕ ਭਰਤਨਾਟਿਅਮ ਕੁਚੀਪੁੜੀ ਨਾਲ ਮਨੋਰੰਜਨ ਕੀਤਾ ਜਾਂਦਾ ਹੈ